ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅੰਕੀਤਾ ਕੁਮਾਰੀ ਆ ਤੁਸੀਂ ਲੱਕੀ ਢਾਬੇ ਤੋਂ ਬੋਲਦੇ ਆਂ ਮੈਂ ਪਿਛਲੀ ਪਿਛਲੇ ਹਫਤੇ ਤੁਹਾਡੇ ਤੋਂ ਮਤਲਬ ਸ਼ੂਪ ਸੂਪ ਔਡਰ ਕੀਤਾ ਸੀ ਉਹ ਵਧੀਆ ਨਹੀਂ ਆਇਆ ਸੀ ਉਹ ਤਾਂ ਉਹ ਠੰਡਾ ਵੀ ਸੀ ਅਤੇ ਪੈਕਜਿੰਗ ਦੇ ਬਾਹਰ ਵੀ ਸੀ ਅਤੇ ਡਿਲੀਵਰੀ ਬੋਏ ਨੇ ਲੇਟ ਵੀ ਲੈ ਕੇ ਆਇਆ ਸੀ ਅਤੇ ਮੈਂ ਤੁਹਾਡੇ ਤੋਂ ਇਸ ਵਾਰੀ ਮਤਲਬ ਵੈੱਜ ਸੂਪ ਮਿਕਸ ਸੂਪ ਟਮੇਟੋ ਸੂਪ ਮਤਲਬ ਦੁਬਾਰਾ ਔਡਰ ਕਰਨਾ ਚਾਹੁੰਦੀ ਹਾਂ ਅਤੇ ਜਾ ਰਹੀ ਹਾਂ ਮਤਲਬ ਤਾਂ ਫੇਰ ਵਧੀਆ ਆਵੇ ਪੈਕਸੀ ਪੈਕਸਿੰਗ ਮਤਲਬ ਉਸਦੀ ਵਧੀਆ ਹੋਵੇ ਅਤੇ ਗਰਮ ਹੋਵੇ ਠੰਡਾ ਨਾ ਪਿਛਲੇ ਵਾਂਗ ਜੈਸੇ ਪਿਛਲੀ ਵਾਰ ਰਿਸ਼ਤੇ ਰਿਸ਼ਤੇਦਾਰਾਂ ਸਾਹਮਣੇ ਮੇਰੀ ਬਹੁਤ ਬੇਇੱਜ਼ਤੀ ਹੋਈ ਹੈ ਫੇਰ ਅਤੇ ਡਿਲੀਵਰੀ ਬੋਏ ਨੂੰ ਕਹਿ ਦਿਆ ਕਰੋ ਕਿ ਫ਼ੋਨ ਵੀ ਚੱਕ ਲਵੇ ਉਹ ਲੇਟ ਆਇਆ ਜੀ ਦੋ ਘੰਟਾ ਲੇਟ ਕਰਤਾ ਜੀ ਅਤੇ ਮੈਂ ਤੁਹਾਡੀ ਸਰਵਿਸਿੰਗ ਬਹੁਤ ਵਧੀਆ ਹੁੰਦੀ ਹੈ ਤਾਂ ਮੈਨੂੰ ਥੋ ਮੈਂ ਤੁਹਾਡੇ ਤੋਂ ਦੁਬਾਰਾ ਔਡਰ ਕਰਨ ਜਾ ਰਹੀ ਹਾਂ ਅਤੇ ਜੇ ਪੈਕਜਿੰਗ ਲਈ ਤੁਹਾਨੂੰ ਐਕਸਟਰਾ ਪੇਅ ਕਰਨੇ ਹੋਏ ਤਾਂ ਮੈਂ ਉਹ ਵੀ ਕਰ ਦੂਗੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ